ਜੀ ਹਾਂ ਮੈਂ ਫੇਸਬੁੱਕ ਇੰਸਟਾਗ੍ਰਾਮ ਤੇ ਅਤੇ ਟਵਿਟਰ ਦੀਆਂ ਖ਼ਬਰਾਂ ਅਤੇ ਅਪਡੇਟ ਪ੍ਰਾਪਤ ਕਰਨ ਲਈ ਵਰਤਦੀ ਹਾਂ ਮੈਨੂੰ ਇਸ ਤੋਂ ਬਹੁਤ ਸਾਰੀਆਂ ਖ਼ਬਰਾਂ ਪ੍ਰਾਪਤ ਹੁੰਦੀਆਂ ਹਨ ਮੇਰੇ ਪਰਿਵਾਰ ਦੇ ਲੋਕ ਵੀ ਇਸ ਚ ਇਸ ਐਪਸ ਦੀ ਵਰਤੋਂ ਕਰਦੇ ਹਨ ਮੇਰੇ ਪਾਪਾ ਖੁਦ ਫੇਸਬੁੱਕ ਤੋਂ ਹੀ ਜ਼ਿਆਦਾਤਰ ਖ਼ਬਰਾਂ ਦੇਖਦੇ ਹਨ ਹਾਂ ਇਹ ਸੱਚ ਹੈ ਕਿ ਇਸ 'ਤੇ ਦਿਖਾਈਆਂ ਸਾਰੀਆਂ ਖ਼ਬਰਾਂ ਸੱਚ ਨਹੀਂ ਹੁੰਦੀਆਂ ਪਰ ਅਸੀਂ ਫਿਰ ਵੀ ਇਸ 'ਤੇ ਥੋੜ੍ਹਾ ਬਹੁਤ ਭਰੋਸਾ ਤਾਂ ਕਰ ਹੀ ਸਕਦੇ ਹਾਂ ਇਸ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਵੀ ਬਹੁਤ ਸਾਰੀਆਂ ਖਬਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਸਾਨੂੰ ਦੇਖ ਸਮਝ ਕੇ ਇਹਨਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ ਹਰ ਖ਼ਬਰ ਝੂਠੀ ਵੀ ਨਹੀਂ ਹੁੰਦੀ ਇਸ ਲਈ ਸਾਨੂੰ ਆਪਣੇ ਦਿਮਾਗ ਅਤੇ ਵਿਵੇਕ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਜੋ ਅਸੀਂ ਸਭ ਸੱਚ ਜਾਣ ਸਕੀਏ ਇਸ ਤੋਂ ਇਲਾਵਾ ਇਹ ਬਹੁਤ ਹੀ ਆਸਾਨ ਤਰੀਕਾ ਹੈ ਜਿਸ ਨਾਲ ਅਸੀਂ ਰੋਜ਼ ਦੀਆਂ ਅਪਡੇਟਸ ਪ੍ਰਾਪਤ ਕਰ ਸਕਦੇ ਹਾਂ ਇਸ ਨਾਲ ਸਾਡਾ ਜੀਵਨ ਬਹੁਤ ਸੌਖਾ ਹੋ ਚੁੱਕਿਆ ਹੈ ਸਾਨੂੰ ਰੋਜ਼ ਹੀ ਨਵੀਆਂ ਨਵੀਆਂ ਅਪਡੇਟਸ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ